ਅੱਜ ਕੱਲ੍ਹ ਖੇਤੀਬਾੜੀ ਨੂੰ ਮਸ਼ੀਨੀ ਯੁੱਗ ਨੇ ਬਹੁਤ ਹੀ ਸੁਖਾਲਾ ਕਰ ਦਿੱਤਾ ਹੈ ਜਿਵੇਂ ਕਿ ਅੱਗੇ ਖੂਹ ਵਰਤੇ ਜਾਂਦੇ ਸੀ ਪਾਣੀ ਲਈ ਅੱਜ ਕੱਲ੍ਹ ਸਬਮਰਸੀਬਲ ਮੋਟਰਾਂ ਆ ਗਈਆਂ ਨੇ ਜਿਸ ਨਾਲ ਕਿ ਬਹੁਤ ਹੀ ਜਲਦ ਵਿੱਚ ਤੁਸੀਂ ਆਪਣਾ ਪਾਣੀ ਦੀ ਜੋ ਵੀ ਜ਼ਰੂਰਤ ਹੈ ਉਹਨੂੰ ਪੂਰਾ ਕਰ ਸਕਦੇ ਹੋ ਉਸ ਤੋਂ ਬਾਅਦ ਟਰੈਕਟਰ ਦੀ ਗੱਲ਼ ਕਰ ਲਈਏ ਕੰਬਾਈਨ ਦੀ ਗੱਲ ਕਰ ਲਈਏ ਉਸ ਨੇ ਬਹੁਤ ਹੀ ਸੁਖਾਲਾ ਕਰ ਦਿੱਤਾ ਹੈ ਖੇਤੀਬਾੜੀ ਨੂੰ ਜੋ ਕਿ ਪਹਿਲਾਂ ਕੰਮ ਬਹੁਤ ਹੀ ਟਾਈਮ 'ਤੇ ਹੁੰਦਾ ਸੀ ਅੱਜ ਕੱਲ੍ਹ ਬੜੀ ਘੱਟ ਟਾਈਮ 'ਚ ਉਸ ਨੂੰ ਆਪਾਂ ਕਿਸਾਨ ਕਰ ਸਕਦੇ ਹਾਂ ਜਿਵੇਂ ਕਿ ਗੱਲ ਕਰ ਲਈਏ ਕਿ ਅੱਗੇ ਲੇਬਰ ਦੀ ਬਹੁਤ ਜ਼ਰੂਰਤ ਪੈਂਦੀ ਸੀ ਅੱਜ ਕੱਲ੍ਹ ਮਸ਼ੀਨੀ ਯੁੱਗ ਨੇ ਲੇਬਰ ਦੀ ਵੀ ਘਾਟ ਨੂੰ ਪੂਰਾ ਕਰ ਦਿੱਤਾ ਹੈ ਗੱਲ ਕਰੀਏ ਕੰਬਾਇਨ ਦੀ ਤਾਂ ਤੁਸੀਂ ਮਿੰਟਾਂ ਵਿੱਚ ਆਪਣੇ ਕਈ ਘੰਟਿਆਂ ਦਾ ਕੰਮ ਕਰ ਸਕਦੇ ਹੋ